ਟੈਲੀਵਿਜ਼ਨ 'ਤੇ ਮੇਰਾ ਮਨ ਪਸੰਦ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਹੈ ਇਹ ਸ਼ੋਅ ਮੈਨੂੰ ਬਹੁਤ ਪਸੰਦ ਹੈ ਇਸ ਵਿੱਚ ਵੱਖੋ ਵੱਖ ਤਰੀਕੇ ਦੇ ਕਿਰਦਾਰ ਨਿਭਾਉਂਦੇ ਹਨ ਇਸ ਵਿੱਚ ਕੋਮੇਡੀ ਸ਼ੋਅ ਡਰਾਮਾ ਸ਼ੋਅ ਅਤੇ ਬਹੁਤ ਵੱਖੋ ਵੱਖਰੇ ਤਰੀਕਿਆਂ ਦਾ ਕਿਰਦਾਰ ਨਿਭਾਇਆ ਜਾਂਦਾ ਹੈ ਇਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਇਹ ਸ਼ੋਅ ਵਿੱਚ ਵੱਖੋ ਵੱਖਰੇ ਤਰੀਕੇ ਦੇ ਗੁਣ ਹੱਸਣਾ ਰੋਣਾ ਸਭ ਕੁਝ ਸਿਖਾਇਆ ਜਾਂਦਾ ਹੈ ਇਹ ਸ਼ੋਅ ਦੁਨੀਆਂ ਭਰ ਦਾ ਕਮੇਡੀਅਨ ਸ਼ੋਅ ਵੀ ਮੰਨਿਆ ਜਾਂਦਾ ਇਸ ਸ਼ੋਅ ਦੇ ਵਿੱਚ ਕਈ ਤਰੀਕੇ ਦੇ ਲੋਕ ਜਿਵੇਂ ਕਿ ਕਈ ਤਰੀਕੇ ਦੇ ਧਰਮ ਦੇ ਲੋਕ ਵੀ ਹਨ ਜੋ ਆਪਣਾ ਕਿਰਦਾਰ ਵੱਖੋ ਵੱਖਰੇ ਤਰੀਕਿਆਂ ਨਾਲ ਨਿਭਾਉਂਦੇ ਹਨ ਇਸ ਸ਼ੋਅ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਬੱਚਿਆਂ ਦਾ ਬੱਚਿਆਂ ਦਾ ਪਸੰਦ ਹੈ ਕਿਉਂਕਿ ਇਸ ਵਿੱਚ ਵੱਖੋ ਕਈ ਤਰੀਕੇ ਦਾ ਡਰਾਮਾ ਵੀ ਹੁੰਦਾ ਹੈ ਜਿਸ ਦੇ ਕਾਰਨ ਸ਼ੋਅ ਦੇਖਣ ਵਿੱਚ ਬਹੁਤ ਮਜ਼ਾ ਆਉਂਦਾ ਹੈ ਵੱਖੋ ਵੱਖਰੇ ਤਰੀਕੇ ਤੇ ਡਰਾਮੇ ਵੱਖੋ ਵੱਖਰੇ ਤਰੀਕੇ ਦੀ ਬਹਿਸ ਵੱਖੋ ਵੱਖਰੇ ਤਰੀਕੇ ਦੇ ਕੈਮੇਡੀ ਸ਼ੋਅ ਸ਼ਾਮਿਲ ਹੁੰਦੇ ਹਨ ਇਸ ਵਿੱਚ ਰਿਐਲਿਟੀ ਨੂੰ ਕੋਮੇਡੀ ਦੇ ਵਿੱਚ ਬਦਲਿਆ ਜਾਂਦਾ ਹੈ ਜਿਸ ਵਿੱਚ ਸਾਨੂੰ ਕਈ ਕਿਰਦਾਰਾਂ ਬਾਰੇ ਵੀ ਪਤਾ ਲੱਗਦਾ ਹੈ ਇਸ ਵਿੱਚ ਦੇਸ਼ ਭਰ ਦੇਸ਼ ਭਰ ਦੀਆਂ ਗੱਲਾਂ ਬਾਰੇ ਦੱਸਿਆ ਜਾਂਦਾ ਹੈ ਇਹ ਸ਼ੋਅ ਮੇਰਾ ਬਚਪਨ ਤੋਂ ਹੀ ਮਨਪਸੰਦੀਦਾ ਸ਼ੋਅ ਹੈ ਇਹ ਸ਼ੋਅ ਮੈਂ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਦੇਖਦਾ ਆ ਰਿਹਾ ਹਾਂ ਇਸ ਵਿੱਚ ਮੈਨੂੰ ਕਾਫੀ ਕੁਛ ਕਾਫੀ ਕੁਝ ਗਿਆਨ ਪ੍ਰਾਪਤ ਹੁੰਦਾ ਹੈ ਇਸ ਸ਼ੋਅ ਦੇ ਨਾਲ ਹੀ ਮੈਨੂੰ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਜਿਸ ਵਿੱਚ ਵੱਡਿਆਂ ਦਾ ਸਤਿਕਾਰ ਕਰਨਾ ਵੀ ਪਤਾ ਲੱਗਦਾ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ ਬੱਚੇ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਪਰ ਕੁਝ ਟੈਲੀਵਿਜ਼ਨ ਸ਼ੋਅ ਵਿੱਚ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜਾਂਦਾ ਹੈ ਇਸ ਕਰਕੇ ਮੈਨੂੰ ਇਹ ਸ਼ੋਅ ਬਹੁਤ ਹੀ ਵਧੀਆ ਅਤੇ ਪਸੰਦੀਦਾ ਸ਼ੋਅ ਲੱਗਦਾ ਹੈ ਮੈਂ ਇਹ ਸ਼ੋਅ ਦੇਖਣਾ ਬਹੁਤ ਪਸੰਦ ਕਰਦਾ ਹਾਂ ਸਮੇਂ ਸਮੇਂ ਦੇ ਨਾਲ ਇਹ ਸ਼ੋਅ ਦੇ ਵਿੱਚ ਕਿਰਦਾਰ ਵੀ ਬਦਲਦੇ ਜਾ ਰਹੇ ਹਨ ਜਿਸ ਦੇ ਨਾਲ ਰਨ ਮੈਨੂੰ ਕਈ ਤਰੀਕੇ ਅਤੇ ਗੱਲਾਂ ਅਤੇ ਰਿਐਲਿਟੀ ਦੇ ਵਿੱਚ ਕੀ ਹੁੰਦਾ ਹੈ ਅਤੇ ਕੀ ਕੀ ਸਾਡੇ ਦੇਸ਼ ਵਿੱਚ ਬਦਲਾਅ ਆ ਰਹੇ ਹਨ ਸਭ ਪਤਾ ਲੱਗਦਾ ਹੈ